ਸ਼ਹੀਦ ਭਗਤ ਜ਼ਿਲ੍ਹੇ ਵਿੱਚ ਮੁੱਖ ਨਸਲੀ ਅਤੇ ਭਾਸ਼ਾਈ ਸਮੂਹ ਹਨ ਇਹ ਸਾਰੇ ਇਕੱਠੇ ਹੀ ਰਹਿੰਦੇ ਨੇ ਆਪਸ ਵਿੱਚ ਗੱਲਬਾਤ ਕਰਦੇ ਹਨ ਕਈਆਂ ਦੀ ਭਾਸ਼ਾ 'ਚ ਥੋੜ੍ਹਾ ਜਿਹਾ ਫਰਕ ਹੈ ਜਾਤਾਂ ਕਬੀਲਿਆਂ ਭਾਸ਼ਾਵਾਂ ਸੱਭਿਆਚਾਰ ਵੀ ਕਈਆਂ ਦਾ ਅਲੱਗ ਹੈ ਕਈ ਕਬੀਲੇ ਇਕੱਠੇ ਰਹਿੰਦੇ ਹੈ ਜਿਵੇਂ ਸੈਂਸੀ ਹੋ ਗਏ ਇਹ ਜਿਹੜੇ ਲੋਕ ਹਨ ਜਾਂ ਬਾਜੀਗਰ ਹਨ ਇਹਨਾਂ ਦਾ ਕੰਮ ਬਾਜ਼ੀਆਂ ਪਾਉਣਾ ਜਾਂ ਲੋਹੇ ਦੀ ਜਿਹੜੇ ਸਮਾਨ ਨੂੰ ਵੇਚਣਾ ਦੂਸਰੇ ਪਾਸੇ ਜਿਹੜੇ ਗੱਡੀਆਂ ਵਾਲੇ ਹਨ ਉਹ ਲੋਹੇ ਦੇ ਸਮਾਨ ਨੂੰ ਏ ਵੇਚਦੇ ਹਨ ਅਤੇ ਘਰ ਤੋਂ ਬਾਹਰ ਅਲੱਗ ਰਹਿੰਦੇ ਹਨ ਅਤੇ ਇਹਨਾਂ ਦੀ ਭਾਸ਼ਾ ਵਿੱਚ ਵੀ ਕਾਫੀ ਫਰਕ ਹੈ ਸਾਡੇ ਜ਼ਿਲ੍ਹੇ ਭਾਸ਼ਾ ਬਦਲਦੀ ਹੈ ਜਦ ਕਹਿੰਦੇ ਹਨ ਤਿੰਨ ਕਿਲੋਮੀਟਰ ਦੇ ਪਾ ਪਾਣੀ ਬਦਲੇ ਅੱਠ ਕਿਲੋਮੀਟਰ ਦੇ ਪਾਣੀ ਅਤੇ ਉਸੇ ਭਾਸ਼ਾ ਵੀ ਬਦਲਦੀ ਆ ਭਾਸ਼ਾ 'ਚ ਬ ਥੋੜ੍ਹਾ ਥੋੜ੍ਹਾ ਜ਼ਿਆਦਾ ਹੀ ਨਹੀਂ ਥੋੜ੍ਹਾ ਥੋੜ੍ਹਾ ਫਰਕ ਹੈ ਜ਼ਿਆਦਾ ਇ ਇਸ ਲੇ ਇਹਦੇ ਵਿੱਚ ਇਲਾਕੇ ਦੇ ਵਿੱਚ ਪੂਰੇ ਪੰਜਾਬ ਚਾਰ ਸੌ ਤਿਹੱਤਰ ਪਿੰਡ ਹਨ ਅਤੇ ਹਰ ਪਿੰਡ ਦੇ ਵਿੱਚ ਅਲੱਗ ਅਲੱਗ ਹੀ ਭਾਸ਼ਾ ਵਿੱਚ ਥੋੜ੍ਹਾ ਥੋੜ੍ਹਾ ਟੱਚ ਹੈ ਆਉਂਦਾ ਹੈ ਜਦੋਂ ਬਦਲਾਵ ਵਿੱਚ ਹੈ ਬਾਕੀ ਜਿਹੜੇ ਸੱਭਿਆਚਾਰਕ ਹੈ ਉਸ ਇੱਕੋ ਜਿਹੇ ਵੀ ਹੈ ਕਿਤੇ ਕਈਆਂ ਦੇ ਬਦਲਦੇ ਵੀ ਹੈ ਪਿੰਡਾਂ 'ਚ ਅਲੱਗ ਅਲੱਗ ਰੁਆਜ਼ ਹੈ ਭਾਸ਼ਾ ਦਾ ਅਤੇ ਪ ਬੋਲੀ ਵੀ ਅਲੱਗ ਅਲੱਗ ਹੈ ਕਈਆਂ ਦੇ ਵਿੱਚ